ਬੇਸ਼ੱਕ ਅੱਜ ਕੱਲ੍ਹ ਅਸੀਂ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਵੈਸੇ ਅਸੀਂ ਰਹਿਣ ਵਾਲੇ ਪਿੰਡਾਂ ਦੇ ਹੀ ਐਂ ਪਿੰਡਾਂ ਦੇ ਵਿੱਚ ਰਹਿ ਕੇ ਖੇਤੀ ਕਰਦੇ ਰਹੇ ਐਂ ਅਤੇ ਹੁਣ ਵੀ ਜਦੋਂ ਜਾਈਦਾ ਤਾਂ ਖੇਤੀ ਬਾਰੇ ਉੱਥੇ ਦੇਖੀਦਾ ਅਤੇ ਸਭ ਤੋਂ ਪਹਿਲਾਂ ਤਾਂ ਖੇਤੀ ਕਰਨ ਦੇ ਖਾਤਰ ਸਾਨੂੰ ਕਰਜਾ ਲੈਣਾ ਪੈਂਦਾ ਜਿਵੇਂ ਕੋਆਪਰੇਟਿਵ ਸੋਸਾਇਟੀਆਂ ਬਣਾਈਆਂ ਹੋਈਆਂ ਕਿਸਾਨਾਂ ਨੂੰ ਉਹਨਾਂ ਤੋਂ ਵੈਸੇ ਤਾਂ ਸਬਸਿਡੀ ਪਹਿਲਾਂ ਮਿਲਦੀ ਹੁੰਦੀ ਅੱਜ ਕੱਲ੍ਹ ਸਬਸਿਡੀ ਤਾਂ ਬੰਦ ਹੈ ਅਤੇ ਥੋੜ੍ਹੇ ਵਿਆਜ਼ 'ਤੇ ਕਰਜ਼ਾ ਮਿਲ ਜਾਂਦਾ ਬਾਕੀ ਜਿਹੜੀ ਫਸਲਾਂ ਦੀ ਗੱਲ ਹੈ ਫਸਲ ਤਾਂ ਜਿਹੜੀ ਆ ਉਹ ਕਿਸਾਨ ਨੂੰ ਖੇਤ ਦੇ ਵਿੱਚ ਮੰਗਦੀ ਹੈ ਉਹ ਜਿਹੜਾ ਖੇਤ ਆ ਉਹ ਕਿਸਾਨ ਨੂੰ ਉਡੀਕਦਾ ਵੀ ਮੇਰਾ ਜਿਹੜਾ ਕਿਸਾਨ ਆ ਉਹ ਲਗਭਗ ਰੋਜ਼ ਏ ਇੱਕ ਗੇੜਾ ਖੇਤ ਦੇ ਵਿੱਚ ਮਾਰਨਾ ਚਾਹੀਦਾ ਮਾਰਦੇ ਵੀ ਹੈਗੇ ਚਲੋ ਇਹ ਤਾਂ ਹੁਣ ਦੁਨੀਆਂਦਾਰੀ ਹੈ ਹੋਰ ਧੰਦੇ ਵੀ ਕਰਨੇ ਪੈਣੇ ਆ ਕੋਈ ਵਿਆਹ ਸ਼ਾਦੀ ਕੋਈ ਜੋ ਵੀ ਬਿਮਾਰੀ ਠਮਾਰੀ ਇਹਦੇ ਵਿੱਚ ਵੀ ਜਾਣਾ ਪੈਂਦਾ ਬਾਕੀ ਫਸਲ ਹੈ ਜਿਹੜੀ ਇਹ ਸਾਨੂੰ ਕਰਜ਼ਾ ਤਾਂ ਚਲੋ ਲੈਣਾ ਹੀ ਪੈਂਦਾ ਕਰਜ਼ਾ ਉਤਾਰ ਦਈਦਾ ਸੀਜ਼ਨ ਤੋਂ ਬਾਅਦ ਕਰਜ਼ਾ ਲਾਹ ਦਿਓ ਅਤੇ ਦੁਬਾਰਾ ਲੈ ਲਓ ਜੇ ਕਰਜ਼ਾ ਨਹੀਂ ਲਾਉਂਗੇ ਤਾਂ ਫਿਰ ਤਾਂ ਆਪਾਂ ਡਿਫਾਲਟਰ ਬਣ ਜਾਵਾਂਗੇ ਨੇ ਅਤੇ ਇਹਦੇ ਖਾਤਰ ਫਸਲਾਂ ਜਿਹੜੀਆਂ ਜਿਵੇਂ ਸਿਆਲ ਦੇ ਵਿੱਚ ਆਪਣਾ ਕਣਕ ਬੀਜਦੇ ਹਾਂ ਉਹ ਗਰਮੀਆਂ ਦੇ ਵਿੱਚ ਵੱਢੀ ਜਾਂਦੀ ਹੈ ਅਤੇ ਅੱਜ ਕੱਲ੍ਹ ਗਰਮੀ ਦੇ ਵਿੱਚ ਆਪਾਂ ਧਾਨ ਲੈਨੇ ਹਾਂ ਉਹ ਲਗਭਗ ਚੜ੍ਹਦੇ ਸਿਆਲ ਤੋਂ ਪਹਿਲਾਂ ਪਹਿਲਾਂ ਉਹ ਕੱਟ ਲੈਂਦੇ ਹਾਂ ਉਸ ਤੋਂ ਬਾਅਦ ਉਹਦੀ ਪਰਾਲੀ ਵੀ ਸਾਂਭਣੀ ਹੈ ਸਾਰਾ ਧੰਦਾ ਜਿਹੜਾ ਹੈਗਾ ਕਿਸਾਨ ਖਾਤਰ ਬਹੁਤ ਜ਼ਰੂਰੀ ਹੈ